ਅਸੀਂ ਧਰਤੀ ਗ੍ਰਹਿ 'ਤੇ ਰਹਿ ਰਹੇ ਹਾਂ ਅਤੇ ਸਾਡੇ ਮੰਨਣਾ ਸੀ ਕਿ ਅਸੀਂ ਸਿਰਫ ਧਰਤੀ ਅਜਿਹਾ ਗ੍ਰਹਿ ਆ ਜਿੱਥੇ ਰਹਿਣ ਯੋਗ ਵਾਤਾਵਰਨ ਸਾਨੂੰ ਮਿਲਿਆ ਹੋਇਆ ਹੈਗਾ ਵਧੀਆ ਤਰੀਕੇ ਨਾਲ ਸਹੂਲਤਾਂ ਮਿਲੀਆਂ ਹੋਈਆਂ ਨੇ ਪਰੰਤੂ ਜਦੋਂ ਅਸੀਂ ਗੁਰਬਾਣੀ ਦੇਖਦੇ ਹਾਂ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਲਿਖਦੇ ਹਨ ਕਿ ਲ ਪਾਤਾਲਾ ਪਤਾਲ ਲੱਖ ਆਗਾਸਾ ਅਗਾਸ ਵੀ ਬਹੁਤ ਜ਼ਿਆਦਾ ਅਜਿਹੀਆਂ ਧਰਤੀਆਂ ਹਨ ਜਿੱਥੇ ਬਹੁਤ ਜ਼ਿਆਦਾ ਜੀਵ ਆ ਬਹੁਤ ਸਮੇਂ ਤੋਂ ਵਾਤਾਵਰਨ ਦੇ ਵਿੱਚ ਰਹਿ ਰਹੇ ਹਨ ਆਪਣਾ ਜੀਵਨ ਬਤੀਤ ਕਰ ਰਹੇ ਹਨ ਤਾਂ ਜਦੋਂ ਇਸ ਨੂੰ ਅੱਜ ਦੇ ਸਮੇਂ ਦੇ ਵਿੱਚ ਵਿਗਿਆਨੀਆਂ ਦੁਆਰਾ ਖੋਜਿਆ ਜਾ ਰਿਹਾ ਹੈ ਪੜਚੋਲਿਆ ਜਾ ਰਿਹਾ ਤਾਂ ਦੇਖਦੇ ਆ ਕਿ ਮੰਗਲ ਗ੍ਰਹਿ 'ਤੇ ਬੋ ਵਿਗਿਆਨੀ ਪਹੁੰਚੇ ਆ ਤਾਂ ਉੱਥੇ ਬਹੁਤ ਜ਼ਿਆਦਾ ਸਾਨੂੰ ਪਾਣੀ ਲੱਭਿਆ ਗਾ ਹੋਰ ਗ੍ਰਹਿ ਜਿਵੇ ਮਾਰਕਸ ਗ੍ਰਹਿ ਉੱਥੇ ਬਹੁਤ ਜ਼ਿਆਦਾ ਸਾਨੂੰ ਗੈਸਾਂ ਲੱਭੀਆਂ ਨੇ ਤਾਂ ਬਹੁਤ ਜ਼ਿਆਦਾ ਉੱਥੇ ਰਹਿਣ ਯੋਗ ਜ਼ਮੀਨ ਆ ਜਿਹੜੀ ਪ੍ਰਾਪਤ ਹੋਈ ਆ ਤਾਂ ਅਜਿਹੀਆਂ ਖੋਜਾਂ ਜਿਹੜੀਆਂ ਉਹ ਬਹੁਤ ਜ਼ਿਆਦਾ ਹੋ ਰਹੀਆਂ ਨੇ ਭਵਿੱਖ ਦੇ ਵਿੱਚ ਵੀ ਅਜਿਹੀਆਂ ਖੋਜਾਂ ਹੋ ਰਹੀਆਂ ਹਨ ਜਿਹੜੀਆਂ ਕਿ ਸਾਨੂੰ ਗ੍ਰਹਿਆਂ ਦੇ ਉੱਤੇ ਵੱਖ ਵੱਖ ਗ੍ਰਹਿਆਂ ਦੇ ਉੱਤੇ ਕਿੱਥੇ ਅਸੀਂ ਰਹਿ ਸਕਦੇ ਹਾਂ ਉੱਥੇ ਸਾਨੂੰ ਕਿਹੜੀਆਂ ਚੀਜ਼ਾਂ ਉਪਲਬਧ ਹੁੰਦੀਆਂ ਹਨ ਕਿ ਉੱਥੇ ਜੀਵਨ ਬਤੀਤ ਕਰਨਾ ਸੰਭਵ ਹੋ ਸਕਦਾ ਹੈ ਇਹ ਜਿਹੜੇ ਵਿਗਿਆਨੀ ਹੈ ਇਸ 'ਤੇ ਕੰਮ ਕਰ ਰਹੇ ਹਨ ਅਤੇ ਹੋ ਸਕਦਾ ਹੈ ਕਿ ਕੋਈ ਧਰਤੀ ਦੇ ਨਾਲ ਅਜਿਹਾ ਕੋਈ ਸਾਨੂੰ ਗ੍ਰਹਿ ਵੀ ਲੱਭ ਸਕੇ ਜਿੱਥੇ ਅਸੀਂ ਆਪਣਾ ਵਧੀਆ ਤਰੀਕੇ ਨਾਲ ਜੀਵਨ ਬਤੀਤ ਕਰ ਸਕੀਏ